ਬੁਣਾਈ ਅਤੇ ਮਸਾਏਸ ਸਿਲਾਈ ਦੀਆਂ ਮਸ਼ੀਨਾਂ ਵਿੱਚ ਜਿਵੇਂ ਹੁਣ ਇਹ ਧਾਗੇ ਸੂਈਆਂ ਫਿਰਕੀਆਂ ਡੱਬੀ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਨੇ ਚੀਜ਼ਾਂ ਵੀ ਆਪਾਂ ਇਹਨਾਂ ਤੋਂ ਬਿਨਾਂ ਸਿਲਾਈ ਨਹੀਂ ਕਰ ਸਕਦੇ ਹੁਣ ਤਾਂ ਵੀ ਕਈ ਪ੍ਰਕਾਰ ਦੀਆਂ ਮਸ਼ੀਨਾਂ ਆ ਗਈਆਂ ਨੇ ਜਿਵੇਂ ਇੰਟਰਲੋਕ ਵਾਲੀ ਪੀਕੋ ਇਹ ਦੂਜੀ ਆ ਗਈ ਤਰਪਾਈ ਵਾਲੀ ਮਸ਼ੀਨ ਵੀ ਆ ਗਈ ਆਸ ਹੁਣ ਆ ਗਈਆਂ ਨੇ ਕਢਾਈ ਵਾਲੀਆਂ ਮਸ਼ੀਨਾਂ ਵੀ ਆਪ ਮੋਬੈਲ 'ਤੇ ਅਟੈਚ ਕਰੀਏ ਅਤੇ ਵੀ ਉਹ ਆਪਣੇ ਆਪ ਹੀ ਸ ਕਢਾਈ ਕਰ ਦਿੰਦੀ ਹੁਣ ਤਾਂ ਵੀ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹਰੇਕ ਚੀਜ਼ ਬਹੁਤ ਬਿਹਤਰ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਵੀ ਹੁਣ ਸੈਂਸ ਸ਼ੋ ਬਹੁਤ ਮਸ਼ੀਨਾਂ ਓ ਵੀ ਸਾਨੂੰ ਚਾਹੀਦੀਆਂ ਵੀ ਮਸ਼ੀਨਾਂ ਬਹੁਤ ਨੇ ਵੀ ਜਿਵੇਂ ਇਹ ਅੱਗੇ ਪੈਰਾਂ 'ਤੇ ਮਸ਼ੀਨ ਹੁੰਦੀ ਸੀ ਹੁਣ ਮਸ਼ੀਨ ਆ ਗਈ ਆ ਦੂਸਰੀ ਮੋਟਰ 'ਤੇ ਕਈ ਤਰ੍ਹਾਂ ਦੀਆਂ ਮਸ਼ੀਨਾਂ ਆ ਚੁੱਕੀਆਂ ਨੇ ਅਤੇ ਆਪਾਂ ਨੂੰ ਸਭ ਤੋਂ ਜ਼ਿਆਦਾ ਤਾਂ ਮਸ਼ੀਨਾਂ ਵਿੱਚ ਜ਼ਰੂਰੀ ਹੁੰਦਾ ਹੈ ਵੀ ਧਾਗਾ ਫਿਰਕੀ ਸੂਈ ਮਸ਼ੀਨ ਵਾਲੀ ਸੂਈ ਤਰਪਾਈ ਵਾਲੀ ਅੱਗੇ ਵੀ ਆਪਾਂ ਹੱਥ 'ਤੇ ਵੀ ਸੀਂ ਲੈਂਦੇ ਸੀ ਕੱਪੜੇ ਹੁਣ ਮਸ਼ੀਨਾਂ ਹੀ ਇਸ ਤਰ੍ਹਾਂ ਦੀਆਂ ਆ ਚੁੱਕੀਆਂ ਨੇ ਵੀ ਕਯਾ ਆਪਾਂ ਨੂੰ ਹੱਥ ਤਾਂ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਹੁਣ ਤਾਂ ਪੈਰਾਂ ਵਾਲੀਆਂ ਮਸ਼ੀਨਾਂ ਅੱਗੇ ਲੋਕ ਹੱਥਾਂ 'ਤੇ ਹੱਥ 'ਤੇ ਮਸ਼ੀਨ ਕਰਦਾ ਹੁੰਦਾ ਸੀ ਹੁਣ ਪੈਰਾਂ 'ਤੇ ਆ ਗਈ ਪੈਰਾਂ ਤੋਂ ਇਲਾਵਾ ਗਾਹ ਹੁਣ ਮੋਟਰਾਂ 'ਤੇ ਆ ਗਈ ਗਾਹ ਵੇਖੋ ਹੁਣ ਸਾਇੰਸ ਕਿੰਨੀ ਕੁ ਤਰੱਕੀ ਕਰਦੀ ਹੈ ਇਹ ਦਾ ਹੁਣ ਵਾਹਿਗੁਰੂ ਹੀ ਜਾਣਦਾ ਧੰਨਵਾਦ